ਜਿਵੇਂ ਕਿ ਮੈਂ ਆਪਣੇ ਘਰ ਵਿੱਚ ਆਪਣੇ ਕਿਹੜੇ ਫੁੱਲ ਹੁੰਦੇ ਗੇਂਦੇ ਦੇ ਗੁਲਾਬ ਦੇ ਹੈ ਨਾ ਸੂਰਜ ਮੁਖੀ ਫੁੱਲ ਲਾਲ ਗੁਲਾਬ ਉਹ ਚਿੱਟੇ ਫੁੱਲ ਕਿੰਨੇ ਸੋਹਣੇ ਲੱਗਦੇ ਲਗਾਏ ਸੀ ਹੈ ਨਾ ਅਤੇ ਮੈਂ ਉਹਨਾਂ ਨੂੰ ਸਮੇਂ ਸਿਰ ਸਮੇਂ ਸਮੇਂ ਸਿਰ ਪਾਣੀ ਦਿੰਦੀ ਰਹੀ ਅਤੇ ਖਾਦ ਪ੍ਰੋਪਰ ਪਾਉਂਦੀ ਰਹੀ ਮਤਲਬ ਕਿ ਇਹ ਨਹੀਂ ਕਿਹਾ ਕਿ ਹਾਂ ਮੈਂ ਇਹਨੂੰ ਚੀਜ਼ ਨੂੰ ਕਿ ਇੱਕ ਵਾਰ ਲਗਾਇਆ ਅਤੇ ਇਗਨੋਰ ਕਰਤਾ ਮਤਲਬ ਕਿ ਬੰਦੇ ਨੂੰ ਸਮੇਂ ਸਮੇਂ ਸਿਰ ਪਾਣੀ ਦੇਣਾ ਚਾਹੀਦਾ ਹੈ ਨਾ ਅਤੇ ਉਹਨਾਂ ਦਾ ਧਿਆਨ ਚੰਗੀ ਤਰਾਂ ਰੱਖਣਾ ਚਾਹੀਦਾ ਕਿ ਹਾਂ ਉਹਨਾਂ ਨੂੰ ਕਦੋਂ ਕਦੋਂ ਪਾਣੀ ਦੇ ਸਮੇਂ ਦੀ ਲੋੜ ਆ ਪਾਣੀ ਦੀ ਹੈ ਨਾ ਪੌਦਿਆਂ ਨੂੰ ਕਿ ਉਹ ਜਬ ਖਿੜਦੇ ਆ ਇਸ ਸਮੇਂ ਉਹਨਾਂ ਨੂੰ ਪਾਣੀ ਦੂਂਗੇ ਇਸ ਸਮੇਂ ਉਹਨਾਂ ਨੁੰ ਖਾਦ ਦੂਂਗੇ ਚੰਗੀ ਤਰਾਂ ਉਹਨਾਂ ਦਾ ਮਤਲਬ ਵਧੀ ਤਰਾਂ ਪ੍ਰੋਪਰ ਉੱਗੂਂਗੇ ਹੈ ਨਾ ਅਤੇ ਸੋਣੇ ਵੀ ਲੱਗੂਂਗੇ ਘਰ 'ਚ ਲਗਾਏ ਹੋਏ ਹਾਂਜੀ ਅਤੇ ਏਦੀ ਮੈਂ ਆਪਣੇ ਫਲਾਂ ਦੀ ਫਲਾਂ ਦੇ ਪੌਦੇ ਲਗਾਏ ਜਿੱਦਾਂ ਕਿ ਆਪਣੇ ਆੜੂ ਹੋ ਗਿਆ ਆੜੂ ਅਮਰੂਦ ਸੰਤਰੇ ਹੈ ਨਾ ਬਹੁਤ ਚੰਗੇ ਲੱਗਦੇ ਸੀ ਕਿਉਂਕਿ ਉਸ ਚੀਜ਼ ਨੂੰ ਯੂਸ ਕਰਨਾ ਖਾਣਾ ਹੈ ਨਾ ਚੰਗੀ ਤਰ੍ਹਾਂ ਪਾਣੀ ਦੋਂਗੇ ਪ੍ਰੋਪਰ ਪਾਣੀ ਦਿੱਤਾ ਫਿਰ ਮੈਂ ਨਾਲ ਦੇ ਬ ਆਪਣੇ ਨਾਲ ਦੇ ਬੂਟੇ ਵੀ ਲੱਗਦੇ ਆ ਹੈ ਨਾ ਅਤੇ ਉਹਨਾਂ ਨੂੰ ਮੈਂ ਪਾਣੀ ਪ੍ਰੋਪਰ ਜਦੋਂ ਲਗਾਏ ਪੌਦਿਆਂ ਨੂੰ ਲਗਾਇਆ ਅਤੇ ਪਾਣੀ ਪ੍ਰੋਪਰ ਅਤੇ ਖਾਦ ਵੀ ਪ੍ਰੋਪਰ ਪਾਈ ਚੰਗੀ ਤਰ੍ਹਾਂ ਹੈ ਨਾ ਅਤੇ ਜਿਦੇ ਮੈਂ ਉਹਨਾਂ ਨੂੰ ਉੱਗਦੇ ਹੋਏ ਦੇਖਿਆ ਮਤਲਬ ਬਹੁਤ ਖੁਸ਼ੀ ਮਿਲਦੀ ਮੈਨੂੰ ਬਹੁਤ ਖੁਸ਼ੀ ਮਿਲੀ ਹੈ ਨਾ ਮਤਲਬ ਅੰਦਰੋਂ ਖੁਸ਼ੀ ਮਿਲਦੀ ਕਿ ਮਨ ਸ਼ਾਂਤ ਸ਼ਾਂਤ ਸ਼ਾਂਤੀ ਮਿਲਦੀ ਬੰਦੇ ਨੂੰ ਹੈ ਨਾ ਹਾਂ ਜੀ ਤਾਂ ਕਰਕੇ ਬੰਦੇ ਨੂੰ ਪੌਦੇ ਲਗਾਉਂਦੇ ਰਹਿਣਾ ਚਾਹੀਦਾ ਹੈਗਾ ਆਨਾ ਨਹੀਂ ਕਰਨਾ ਚਾਹੀਦਾ